ਗਿਆਰ੍ਹਾਂ ਅਪ੍ਰੈਲ ਉੱਨੀ ਸੌ ਚੁਰਾਸੀ ਦੋ ਅਕਤੂਬਰ ਉੱਨੀ ਸੌ ਪੈਂਹਠ ਛੱਬੀ ਜਨਵਰੀ ਉੱਨੀ ਸੌ ਪੰਜਾਹ ਦਸ ਦਸੰਬਰ ਉੱਨੀ ਸੌ ਚੁਰਾਨਵੇਂ ਪੰਦਰ੍ਹਾਂ ਅਗਸਤ ਉੱਨੀ ਸੌ ਸੰਤਾਲੀ